ਸਭ ਤੋਂ ਪਹਿਲਾਂ ਖਾਣਾ ਬਣਾਉਣ ਲੱਗੇ ਸਫ਼ਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ ਜਿਨ੍ਹਾਂ ਭਾਂਡਿਆਂ ਵਿੱਚ ਖਾਣਾ ਪਕਾਉਣਾ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਂਦਾ ਹੈ ਚੰਗੀ ਤਰ੍ਹਾਂ ਹੱਥ ਧੋ ਕੇ ਸਬਜ਼ੀਆਂ ਨੂੰ ਸਾਫ਼ ਪਾਣੀ ਨਾਲ ਧੋਇਆ ਜਾਂਦਾ ਹੈ ਸਬਜ਼ੀਆਂ ਤਾਜ਼ੀਆਂ ਹੀ ਖਰੀਦ ਕੇ ਵਰਤਦੇ ਹਾਂ ਸਬਜ਼ੀਆਂ ਨੂੰ ਨਮਕ ਸਿਰਕੇ ਅਤੇ ਹਲਦੀ ਵਾਲੇ ਪਾਣੀ ਨਾਲ ਧੋ ਕੇ ਵਰਤਿਆ ਜਾਂਦਾ ਹੈ ਤਾਂ ਜੋ ਉਹਨਾਂ ਤੋਂ ਕੀਟਨਾਸ਼ਕ ਦਵਾਈਆਂ ਦਾ ਅਸਰ ਖਤਮ ਹੋ ਜਾਵੇ ਖਾਣਾ ਰਿਫਾਇੰਡ ਤੇਲ ਦੀ ਬਜਾਏ ਸ਼ੁੱਧ ਦੇਸੀ ਘੀ ਅਤੇ ਸਰ੍ਹੋਂ ਦੇ ਤੇਲ ਵਿੱਚ ਹੀ ਬਣਾਇਆ ਜਾਂਦਾ ਹੈ ਖਾਣਾ ਧੀਮੇ ਸੇਕ 'ਤੇ ਪਕਾਇਆ ਜਾਂਦਾ ਹੈ ਦਾਲਾਂ ਵਗੈਰਾ ਕੁੱਕਰ ਦੀ ਬਜਾਏ ਤੌੜੀ ਵਿੱਚ ਬਣਾਉਂਦੇ ਹਾਂ ਤਾਂ ਜੋ ਉਹਨਾਂ ਦੇ ਗੁਣਕਾਰੀ ਤੱਤ ਉਹਨਾਂ ਵਿੱਚ ਮੌਜੂਦ ਰਹਿਣ ਖਾਣੇ ਵਿੱਚ ਜ਼ਿਆਦਾ ਮਿਰਚ ਮਸਾਲੇ ਦੀ ਵਰਤੋਂ ਵੀ ਨਹੀਂ ਕੀਤੀ ਜਾਂਦੀ